ਹੈਲੋ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਨੂੰ ਵਰਿੰਦਰ ਬਾਈ ਨੇ ਤੁਹਾਡਾ ਉਹ ਫੋਨ ਨੰਬਰ ਦਿੱਤਾ ਤਾ ਜੀ ਅਸੀਂ ਨਵੇਂ ਸ਼ਿਫਟ ਹੋਏ ਹਾਂ ਕਪੂਰਥਲੇ 'ਚ ਹਾਂਜੀ ਅਤੇ ਸਰ ਉਹਨਾਂ ਨੇ ਭਾਅ ਜੀ ਨੇ ਕਿਹਾ ਸੀਗਾ ਵੀ ਕੋਈ ਵੀ ਪ੍ਰੋਬਲਮ ਹੋਈ ਤੂੰ ਭਾਅ ਜੀ ਤੋਂ ਪੁੱਛ ਲਈ ਹਾਂਜੀ ਅਤੇ ਭਾਅ ਜੀ ਮੈਂ ਨਾ ਆਪਣੇ ਬੱਚੇ ਲਗਾਉਣੇ ਆ ਜੀ ਸਕੂਲ 'ਚ ਅਤੇ ਮੈਂ ਉਰੇ ਕਿਹੜਾ ਬੈਸਟ ਸਕੂਲ ਆ ਵੀ ਜਿਹਦੇ 'ਚ ਆਪਣੇ ਬੱਚੇ ਲਗਾ ਸਕਦਾ ਹਾਂਜੀ ਹਾਂਜੀ ਸਰ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ

ਹਾਂਜੀ ਅਤੇ ਸਰ ਇਹ ਸੀ ਅੱਛਾ ਜੀ

ਹਾਂਜੀ ਹਾਂਜੀ ਸਰ ਇਹ ਸੀ ਬੀ ਐਸ ਈ ਹੈ ਜਾਂ ਪੰਜਾਬ ਬੋਰਡ ਸਕੂਲ ਹੈ ਜੀ ਠੀਕ ਹੈ ਜੀ ਹਾਂਜੀ ਨਹੀਂ ਮੈਂ ਸੀ ਬੀ ਐਸ ਈ ਓ ਦੇਖਦਾ ਜੀ ਸਰਚ ਕਰਦਾ ਸੀ ਬੀ ਐਸ ਈ ਓ

ਅੱਛਾ ਜੀ ਹਾਂਜੀ

ਅੱਛਾ ਜੀ ਹਾਂਜੀ ਹਾਂਜੀ ਹਾਂਜੀ ਚੱਲੋ ਠੀਕ ਆ ਭਾਅ ਜੀ ਫਿਰ ਹਾਂਜੀ ਜੇ ਮੈਨੂੰ ਕੋਈ ਹੋਰ ਦਿੱਕਤ ਹੋਈ ਮੈਂ ਤੁਹਾਨੂੰ ਕਾਲ ਕਰਕੇ ਪੁੱਛ ਲਵਾਂਗਾ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਵਧੀਆ ਇਨਫੋਰਮੇਸ਼ਨ ਦਿੱਤੀ ਸਾਨੂੰ

ਹਾਂਜੀ ਠੀਕ ਹੈ ਜੀ ਧੰਨਵਾਦ ਜੀ ਓਕੇ